ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਇੰਨੇ ਇੰਨੇ ਮਹਿੰਗੇ ਬੂਟ ਇੰਨੇ ਮਹਿੰਗੇ ਕਦੇ ਮੈਂ ਪਾਏ ਨਹੀਂ ਦਸ ਹਜ਼ਾਰ ਤੱਕ ਕਿਹੋ ਜਿਹੀਆਂ ਗੱਲਾਂ ਤੁਸੀਂ ਕਰਦੇ ਹੋ ਭੈਣ ਜੀ ਨਹੀਂ ਨਹੀਂ ਸਿੱਧੀ ਗੱਲ ਹੈ ਜਿਹੜੇ ਤੁਸੀਂ ਪੰਜ ਹਜ਼ਾਰ ਦੇ ਬੂਟ ਹੈ ਨਾ ਕਰੋੜਪਤੀ ਆ ਅਸੀਂ ਕਰੋੜਪਤੀ ਥੋੜ੍ਹੇ ਨਾ ਹੈ ਅੱਛਾ ਠੀਕ ਹੈ ਠੀਕ ਹੈ ਜਿਹੜੇ ਤੁਸੀਂ ਹਜ਼ਾਰ ਰੁਪਏ ਬੂਟ ਲਾਏ ਨਾ ਮੇਰੀ ਪੰਜ ਸੌ ਰੁਪਏ ਦੇ ਦਿਓ ਮੈਂ ਦੋ ਜੋੜੀ ਲੈ ਲਾਂਗਾ ਬ੍ਰੈਂਡਿਡ ਇੰਨੇ ਸਸਤੇ ਥੋੜ੍ਹੇ ਨਾ ਆਉਂਦੇ ਹੈ ਮੇਰੇ ਮੁੰਡੇ ਨੇ ਹਜੇ ਕੱਲ੍ਹ ਲਿਆਂਦੇ ਆ ਬ੍ਰੈਂਡਿਡ ਉਹ ਬੋਲਦਾ ਮੈਂ ਪੰਦਰਾਂ ਹਜ਼ਾਰ ਦੇ ਬੂਟ ਲਿਆਂਦੇ ਆ ਮੈਂ ਉਸ ਮਾਰੀ ਮਾਰੀ ਹਲਾਲ ਕਰੇਗਾ ਨਹੀਂ ਨਹੀਂ ਸਿੱਧੀ ਜਿਹੀ ਗੱਲ ਹੈ ਯਾਰ ਮੈਨੂੰ ਨਹੀਂ ਲੱਗਦਾ ਕੋਈ ਵੀ ਬੂਟ ਤੁਸੀਂ ਮਹਿੰਗੇ ਹੀ ਬੜੇ ਲਾਏ ਆ ਇੰਨੇ ਦੇ ਮੈਂ ਦਸ ਬੂਟ ਲੈ ਲੈਣੇ ਜਿੰਨੇ ਤੁਸੀਂ ਲਾਏ ਹੈ ਹਾਂ ਠੀਕ ਹੈ ਬਾਏ